ਸੰਗੀਤ ਜਾਂ ਗਾਇਕੀ ਦੇ ਵਿੱਚ ਸੁਰ ਅਤੇ ਤਾਲ ਦੋ ਬਹੁਤ ਮਹੱਤਵਪੂਰਨ ਅੰਗ ਹਨ ਅਤੇ ਗਾਇਕੀ ਜੋ ਹੈ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਪਰ ਅਜੋਕੇ ਸਮੇਂ ਦੇ ਵਿੱਚ ਗਾਇਕ ਅਤੇ ਸੰਗੀਤਕਾਰ ਇਸ ਅਹਿਮ ਅੰਗ ਨੂੰ ਨਜ਼ਰ ਅੰਦਾਜ਼ ਕਰ ਦਿੰਦੇ ਹਨ ਤਾਂ ਗਾਇਕੀ ਭਾਵਨਾਵਾਂ ਨੂੰ ਪ੍ਰਗਟ ਕਰਨ ਦਾ ਇੱਕ ਬਹੁਤ ਵਧੀਆ ਜ਼ਰੀਆ ਹੈ ਅਤੇ ਬਿਨਾਂ ਭਾਵਨਾਵਾਂ ਨੂੰ ਪ੍ਰਗਟ ਕੀਤੇ ਗਾਇਕੀ ਜੋ ਹੈ ਉਹ ਅਧੂਰੀ ਹੈ ਉਦਾਹਰਣ ਦੇ ਤੌਰ 'ਤੇ ਜੇ ਕੋਈ ਗਾਇਕ ਇੱਕ ਉਦਾਸ ਗੀਤ ਗਾ ਰਿਹਾ ਹੈ ਅਤੇ ਉਸ ਉਦਾਸੀ ਦੀਆਂ ਭਾਵਨਾਵਾਂ ਨੂੰ ਉਹ ਪ੍ਰਗਟ ਨਹੀਂ ਕਰ ਪਾ ਰਿਹਾ ਤਾਂ ਉਸਦੀ ਗਾਇਕੀ ਜੋ ਹੈ ਉਹ ਅਧੂਰੀ ਲੱਗੇਗੀ ਅਤੇ ਇਸ ਤਰ੍ਹਾਂ ਜੇ ਕੋਈ ਗਾਇਕ ਇੱਕ ਖੁਸ਼ੀ ਭਰੇ ਗੀਤ ਨੂੰ ਇੱਕ ਗਮ ਭਰੇ ਅੰਦਾਜ਼ ਦੇ ਵਿੱਚ ਜਾਂ ਗਮ ਭਰੀ ਭਾਵਨਾ ਦੇ ਨਾਲ ਗਾ ਰਿਹਾ ਹੈ ਤਾਂ ਉਸ ਗਾਇਕੀ ਦਾ ਕੋਈ ਪ੍ਰਭਾਵ ਜੋ ਹੈ ਉਹ ਨਹੀਂ ਪਵੇਗਾ ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਭਾਵਨਾਵਾਂ ਜੋ ਹਨ ਉਹ ਗਾਇਕੀ ਦੇ ਵਿੱਚ ਇੱਕ ਅਹਿਮ ਭੂਮਿਕਾ ਅਦਾ ਕਰਦੀਆਂ ਹਨ